ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਅਰਥਚਾਰੇ ਦਾ ਵਿਕਾਸ ਬਹੁਤ ਹੀ ਤਰੀਕੇ ਨਾਲ ਕੀਤਾ ਜਾਂਚ ਜਾ ਰਿਹਾ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਬੇਰੁਜ਼ਗਾਰੀ ਨੂੰ ਲੈ ਕੇ ਕਾਫੀ ਦਿੱਕਤ ਆ ਰਹੀ ਪਰ ਹੁਣ ਸਰਕਾਰ ਨੇ ਕਾਫੀ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਹੋਈਆਂ ਜਿਸ ਦੇ ਵਿੱਚ ਨੌਜਵਾਨ ਉਸ ਫਾਰਮ ਨੂੰ ਭਰ ਕੇ ਨੌਕਰੀਆਂ ਹਾਸਲ ਕਰ ਰਹੇ ਹਨ ਅਤੇ ਦੇਖਿਆ ਜਾਵੇ ਕਿ ਆਪਣਾ ਬਹੁਤ ਸਾਰੀ ਮੁਹਿੰਮਾਂ ਚਲਾਈਆਂ ਗਈਆਂ ਹਨ ਸਰਕਾਰ ਵੱਲੋਂ ਜਿਵੇਂ ਤੀਰਥ ਯਾਤਰਾ ਸਕੀਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਜਿਹਦਾ ਆਨੰਦ ਹਰ ਕੋਈ ਭਾਰਤੀ ਲੈ ਰਿਹਾ ਹੈ ਠੀਕ ਹੈ ਹੁਣ ਜਿਵੇਂ ਆਪਾਂ ਗੱਲ ਕਰੀਏ ਇੰਟਰਨੈੱਟ ਬੈਂਕਿੰਗ ਡਿਜ਼ੀਟਲ ਭੁਗਤਾਨ ਨੇ ਕਿਵੇਂ ਮਦਦ ਕੀਤੀ ਹੈ ਅਤੇ ਇਹਦੇ ਵਿੱਚ ਜਿਵੇਂ ਆਪਾਂ ਵਰਲਡਵਾਈਡ ਕਨੈਕਟ ਹੋ ਰਹੇ ਇੱਕ ਦੂਜੇ ਨਾਲ ਸਾਡਾ ਕੋਈ ਰਿਸ਼ਤੇਦਾਰ ਬਾਹਰ ਬੈਠਾ ਜਾਂ ਕੋਈ ਦੋਸਤ ਬਾਹਰ ਬੈਠਾ ਆਪਾਂ ਉਹ ਨਾਲ ਲੈਣ ਦੇਣ ਕਰ ਪਾ ਰਹੇ ਹਾਂ ਆਸਾਨੀ ਨਾਲ ਇਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਹੈ ਅਤੇ ਕੁਛ ਹੀ ਛਣਾਂ ਦੇ ਵਿੱਚ ਸਾਡੇ ਪੈਸੇ ਇੱਧਰ ਤੋਂ ਉੱਧਰ ਪਹੁੰਚ ਜਾਂਦੇ ਆ ਜ਼ਿਆਦਾ ਸਾਨੂੰ ਵੇਟ ਨਹੀਂ ਕਰਨੀ ਪੈਂਦੀ ਅਤੇ ਬਹੁਤ ਹੀ ਮਤਲਬ ਵਧੀਆ ਚੀਜ਼ ਹੈ ਜੋ ਵੀ ਡਿਜ਼ੀਟਲ ਬੈਂਕਿੰਗ ਵਗੈਰਾ ਆ ਕਿ ਜਿਹੜੀ ਆਪਾਂ ਯੂਸ ਕਰਦੇ ਹਾਂ ਠੀਕ ਹੈ ਇਹ ਨਾਲ ਸਾਡੀ ਪੇਅਮੈਂਟ ਵੀ ਸਿਕਿਓਰ ਰਹਿੰਦੀ ਆ ਅਤੇ ਜਲਦ ਤੋਂ ਜਲਦ ਇੱਧਰ ਤੋਂ ਉੱਧਰ ਪਹੁੰਚ ਜਾਂਦੀ ਆ